ਮੇਰਾ ਨਾਮ ਨੈਨਸੀ ਹੈ ਸਾਡੇ ਇੱਥੇ ਭਾ ਭੱਠਾ ਸਾਹਿਬ ਵਿੱਚ ਇੱਕ ਮੰਡੀ ਲੱਗਦੀ ਹੈ ਮੈਂ ਤੁਹਾਨੂੰ ਮੱਧ ਪੁਰਸ਼ ਤੁਹਾਡੀਆਂ ਫਸਲਾਂ ਉਤਪਾਦਾਂ ਨੂੰ ਵੇਚਣ ਵਿੱਚ ਤੁਹਾਡੀ ਮਦਦ ਕਿਵੇਂ ਕਰ ਸਕਦੀ ਹਾਂ ਜਿਵੇਂ ਕਿ ਅਸੀਂ ਮੱਧ ਪੁਰਸ਼ ਅੱਗੇ ਸਬਜ਼ੀਆਂ ਨੂੰ ਵੇਚਣ ਲਈ ਭੇਜਦੇ ਹਾਂ ਉੱਥੇ ਘੱਟ ਵੱਧ ਰੇਟਾਂ ਵਿੱਚ ਵੇਚੀ ਜਾਂਦੀ ਹੈ ਅਤੇ ਕੁਝ ਮੱਧ ਪੁਰਸ਼ ਕਿਸਾਨਾਂ ਘੱਟ ਪੈਸੇ ਦਿੰਦੇ ਹਨ ਅਤੇ ਅੱਗੇ ਵੱਧ ਕੇ ਵੱਧ ਵੇਚਦੇ ਹੈ ਇਸ ਕਰਕੇ ਕਈ ਕਿਸਾਨਾਂ ਨੂੰ ਨੁਕਸਾਨ ਹੁੰਦਾ ਹੈ ਅਤੇ ਉਹ ਘਾਟੇ ਕਰਕੇ ਆਤਮ ਹੱਤਿਆ ਕਰ ਕਰਦਾ ਹੈ ਅਤੇ ਕਈ ਕਿਸਾਨਾਂ ਖੁਦ ਆਪ ਮੱਧ ਪੁਰਸ਼ ਬਣ ਜਾਂਦੇ ਹਨ ਜੋ ਕਿ ਮੁਨਾਫਾ ਕਮਾਉਂਦੇ ਹਨ